ਮੈਂ ਪੰਜਾਬ ਦੀ ਇੱਕ ਵਸਨੀਕ ਹਾਂ ਅਤੇ ਮੇਰਾ ਜਨਮ ਪੰਜਾਬ ਵਿਖੇ ਹੀ ਹੋਇਆ ਹੈ ਜਿਸ ਕਾਰਨ ਪੰਜਾਬੀ ਮੇਰੀ ਮਾਂ ਬੋਲੀ ਹੈ ਸਾਡੇ ਪੰਜਾਬ ਵਿੱਚ ਪੰਜਾਬੀ ਦੀ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਕਿਉਂਕਿ ਇਹ ਨਾ ਕੇਵਲ ਸਾਡੀ ਬੋਲਚਾਲ ਲਿਖਤੀ ਭਾਸ਼ਾ ਹੈ ਸਗੋਂ ਇਹ ਸਗੋਂ ਇਹ ਸਾਡੀ ਮਾਂ ਬੋਲੀ ਵਜੋਂ ਵਰਤੀ ਜਾਂਦੀ ਹੈ ਸਿੱਖਿਆ ਪ੍ਰਣਾਲੀ ਵਿੱਚ ਇਸਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਕਿਉਂਕਿ ਜਿਹੜਾ ਵਿਅਕਤੀ ਇੱਕ ਆਪਣੀ ਭਾਸ਼ਾ ਵਿੱਚ ਜੋ ਕੁਛ ਸਿੱਖਦਾ ਹੈ ਉਹ ਕਿਸੇ ਹੋਰ ਭਾਸ਼ਾ ਦੇ ਵਿੱਚ ਨਹੀਂ ਸਿੱਖ ਸਕਦਾ ਜਿਸ ਕਾਰਨ ਉਸਨੂੰ ਆਪਣੀ ਮਾਂ ਬੋਲੀ ਅਤੇ ਆਪਣੀ ਮਾਤ ਭਾਸ਼ਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਇਹ ਕੰਮ ਸਾਡੀ ਸਿੱਖਿਆ ਪ੍ਰਣਾਲੀ ਕਰਦੀ ਹੈ ਉਹ ਸਾਨੂੰ ਜੋ ਕੁਛ ਸਿਖਾਉਂਦੀ ਹੈ ਉਹ ਆਪਣੀ ਮਾਤ ਭਾਸ਼ਾ ਦੇ ਵਿੱਚ ਸਿਖਾਉਂਦੀ ਹੈ ਜਿਸ ਨਾਲ ਅਸੀਂ ਉਸ ਚੀਜ਼ ਨੂੰ ਸੌਖੇ ਸਮਝ ਸਕਦੇ ਹਾਂ ਪੰਜਾਬੀ ਨਾ ਕੇਵਲ ਇੱਕ ਸੌਖੀ ਭਾਸ਼ਾ ਹੈ ਸਗੋਂ ਉਹ ਬਹੁਤ ਹੀ ਲਾਹੇਵੰਦ ਲਾਭਦਾਇਕ ਅਤੇ ਆਮ ਬੋਲਚਾਲ ਦਾ ਸਾਧਨ ਵੀ ਹੈ